ਕਾਫੀ ਪੁਰਾਣੀ ਗੱਲ ਹੈ ਕਿ ਮੈਂ ਕਾਫੀ ਮੈਨੂੰ ਛੁੱਟੀਆਂ ਪਈਆਂ ਸੀ ਮੈਨੂੰ ਆਪਣੇ ਕੋਲਜ ਤੋਂ ਅਤੇ ਮੈਂ ਘਰ ਜਾਣਾ ਸੀ ਅਤੇ ਅਰਜੰਟ ਘਰ ਜਾਣਾ ਸੀ ਅਤੇ ਕਾਫੀ ਰਾਤ ਦਾ ਸਮੇਂ ਸੀ ਅਤੇ ਮੈਨੂੰ ਕੋਈ ਗੱਡੀ ਨਹੀਂ ਮਿਲਦੀ ਸੀ ਜਾਂ ਕੋਈ ਵੀ ਸੁਵਿਧਾ ਨਹੀਂ ਸੀ ਮੇਰੇ ਕੋਲ ਕਿਉਂਕਿ ਮੈਂ ਘਰ ਕਿਸ ਤਰ੍ਹਾਂ ਜਾਵਾਂ ਇਸ ਕਰਕੇ ਮੈਂ ਓਲਾ ਦੀ ਕੈਬ ਬੁੱਕ ਕੀਤੀ ਓਲਾ ਦੀ ਕੈਬ ਕਾਫੀ ਘੱਟ ਸਮੇਂ ਵਿੱਚ ਉੱਥੇ ਆ ਗਈ ਅਤੇ ਮੈਨੂੰ ਕਾਫੀ ਉਹਨਾਂ ਨੇ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਕਿੱਥੇ ਜਾਣਾ ਆਪਣੀ ਲੌਕੇਸ਼ਨ ਓ ਟੀ ਪੀ ਦੇ ਦਿਉ ਜਾਂ ਕਾਫੀ ਅੱਛਾ ਡਰਾਈਵਰ ਸੀ ਪਰ ਮੇਰੇ ਫਾਦਰ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਕੈਬ ਡਰਾਈਵਰ ਨਾਲ਼ ਗੱਲ ਕਰ ਕੈਬ ਡਰਾਈਵਰ ਕਿਤੇ ਸ਼ਰਾਬ ਸ਼ਰੂਬ ਤਾਂ ਨਹੀਂ ਪੀਤੀ ਹੈ ਜਾਂ ਕੋਈ ਨਸ਼ੇੜੀ ਨਸ਼ੁੜੀ ਤਾਂ ਨਹੀਂ ਹੈਗਾ ਜਾਂ ਕੁਛ ਹੋਰ ਤਾਂ ਨਹੀਂ ਚੀਜ਼ ਹੈਗੀ ਪਰ ਨਹੀਂ ਉਹ ਬਿਲਕੁਲ ਸੋਫੀ ਇਨਸਾਨ ਸੀ ਬਿਲਕੁਲ ਅੱਛਾ ਇਨਸਾਨ ਸੀ ਉਹਨੇ ਮੇਰੇ ਨਾਲ ਕਾਫੀ ਸਹੀ ਤਰ੍ਹਾਂ ਗੱਲ ਕੀਤੀ ਉਹ ਸਾਰੀ ਰਾਹ ਵਿੱਚ ਮੈਨੂੰ ਕਾਫੀ ਅੱਛੇ ਤਰੀਕੇ ਗੱਲ ਕਰਦਾ ਆਇਆ ਜਿਸ ਕਾਰਨ ਮੇਰਾ ਸਫਰ ਕਾਫੀ ਅੱਛਾ ਜਾਂਦਾ ਰਿਹਾ ਮੈਂ ਉਹਦਾ ਕਾਫੀ ਧੰਨਵਾਦ ਕਰਾਂਗਾ ਕਿ ਉਹ ਇੱਕ ਅੱਛਾ ਮੈਨੂੰ ਇੱਕ ਅੱਛੀ ਚੀਜ਼ ਹੈ ਜਿਹੜੀ ਏ ਓਲਾ ਬਣੀ ਓਲਾ ਕੰਪਨੀ ਹੈ ਇਹ ਕਾਫੀ ਅੱਛੀ ਡਰਾਈਵਰਾਂ ਨੂੰ ਭੇਜਦੀ ਹੈ ਅਤੇ ਕਾਫੀ ਇੱਕ ਸੁਵਿਧਾ ਅੱਛੀ ਹੈ ਕਿ ਆਪਾਂ ਕਿਸੇ ਟਾਈਮ ਰਾਤ ਨੂੰ ਦਿੱਕਤ ਹੋ ਜਾਵੇ ਤਾਂ ਆਪਾਂ ਉਹਨਾਂ ਨੂੰ ਕੌਲ ਕਰ ਸਕਦੇ ਹਾਂ ਕਿ ਸਾਨੂੰ ਬਈ ਇਸ ਮਤਲਬ ਕਿ ਕੈਬ ਚਾਹੀਦੀ ਆ ਜਗ੍ਹਾ ਚਾਹੀਦੀ ਆ ਉਹਨਾਂ ਦੇ ਚਾਰਜਿਸ ਵੀ ਬਿਲਕੁਲ ਘੱਟ ਸੀ ਚਾਰਜਿਸ ਵੀ ਬਹੁਤ ਘੱਟ ਸੀ ਅਤੇ ਉਹਨਾਂ ਨੇ ਮੈਨੂੰ ਕਾਫੀ ਅੱਛੇ ਤਰੀਕੇ ਨਾਲ ਮੇਰੇ ਘਰ ਡੇਸਟੀਨੇਸ਼ਨ 'ਤੇ ਪਹੁੰਚਾਇਆ ਅਤੇ ਮੈਂ ਉਹ ਕੈਬ ਡਰਾਈਵਰ ਦਾ ਨੰਬਰ ਵੀ ਲੈ ਲਿਆ ਕਿ ਤਾਂ ਕਿ ਉਹਨੂੰ ਮੈਂ ਫੋਨ ਕ ਦੁਬਾਰਾ ਤੋਂ ਫੋਨ ਕਰਾਂ ਅਤੇ ਮੈਂ ਉਹ ਉਹੀ ਆਏ ਕਿਉਂਕਿ ਕਾਫੀ ਅੱਛਾ ਡਰਾਈਵਰ ਸੀ ਅਤੇ ਇਸ ਕਰਕੇ ਮੈਂ ਉਹਨੂੰ ਹੀ ਫੋਨ ਕਰਦਾ ਵਾਂ ਹੁਣ ਜਦੋਂ ਵੀ ਕਿਤੇ ਜਾਂਦਾ ਵਾ ਅਤੇ ਓਲਾ ਕੰਪਨੀ ਦਾ ਮੈਂ ਕਾਫੀ ਧੰਨਵਾਦ ਕਰਨਾ ਚਾਹਾਂਗਾ ਕਿ ਉਸ ਟਾਈਮ ਉਹ ਮੇਰੇ ਮਾੜੇ ਮੇਰੇ ਮੁਸ਼ਕਲ ਟਾਈਮ ਵਿੱਚ ਮੇਰੇ ਸਾਥ ਮੇਰਾ ਕੰਮ ਕੀ ਮੇਰਾ ਸਾਥ ਦਿੱਤਾ ਉਹਨਾਂ ਨੇ ਅਤੇ ਕਾਫੀ ਮੈਨੂੰ ਕੋਈ ਡਰ ਖੌਫ ਨਹੀਂ ਰਿਹਾ ਉਹਨਾਂ ਦੇ ਨਾਲ ਜਾਣ 'ਤੇ